ਸਤਿ ਸ਼੍ਰੀ ਅਕਾਲ ਜੀ ਮੈਂ ਕਾਰਤਿਕ ਪਠਾਨਕੋਟ ਤੋਂ ਬੋਲ ਰਿਹਾ ਮੈਨੂੰ ਬਾਇਕ ਦਾ ਬਹੁਤ ਸ਼ੌਂਕ ਹੈ ਮੇਰਾ ਇੱਕ ਛੋਟਾ ਜਿਹਾ ਡਰੀਮ ਹੈ ਮੈਂ ਵੱਡੇ ਹੋ ਕੇ ਰਾਈਡਰ ਬਣਨਾ ਚਾਹੁੰਦਾ ਹਾਂ ਅਤੇ ਸਾਨੂੰ ਬਾਇਕ ਦੇ ਬਹੁਤ ਬਹੁਤ ਸਾਰੇ ਫ਼ਾਇਦੇ ਹਨ ਬਾਈਕ 'ਤੇ ਅਸੀਂ ਵੱਖ ਵੱਖ ਵੱਖ ਵੱਖ ਜਗ੍ਹਾ ਦੇਖ ਸਕਦੇ ਹਾਂ ਖੁੱਲ੍ਹੀ ਹਵਾ ਲੈ ਸਕਦੇ ਹਾਂ ਬਾਇਕ 'ਤੇ ਮੈਂ ਅੱਜ ਅੱਜ ਤੱਕ ਬਾਇਕ 'ਤੇ ਬਹੁਤ ਦੂਰ ਦੂਰ ਗਿਆ ਕੁੱਲੀ ਕੁੱਲੂ ਮਨਾਲੀ ਔਰ ਔਰ ਕਾਫ਼ੀ ਕਾਫ਼ੀ ਜਗ੍ਹਾ 'ਤੇ ਗਿਆ ਹਾਂ ਅਤੇ ਬਾਇਕ 'ਤੇ ਮਜ਼ਾ ਬਹੁਤ ਹੀ ਆਨੰਦ ਆਉਂਦਾ ਹੈ ਸਾਨੂੰ ਬਾਇਕ ਬਾਇਕ 'ਤੇ ਆਨੰਦ ਬਹੁਤ ਆਉਂਦਾ ਹੈ ਬਾਇਕ ਬਾਇਕ ਚਲਾਉਣ ਦਾ ਵੀ ਨਜ਼ਾਰਾ ਕੁਛ ਹੋਰ ਹੀ ਹੁੰਦਾ ਹੈ ਬਾਇਕ ਮੈਨੂੰ ਸ਼ੌਂਕ ਹੀ ਬਾਇਕ ਦਾ ਰਾਈਡਰ ਬਣਨ ਦਾ ਇਸ ਕਰਕੇ ਮੈ ਮੈਂ ਮੇਰਾ ਮੇਰਾ ਸੁਪਨਾ ਹੈ ਕਿ ਮੈਂ ਨਿੰਜਾ ਐੱਚ ਟੂ ਆਰ ਖਰੀਦਾਂ ਜਿਸ 'ਤੇ ਜੋ ਕਿ ਬਹੁਤ ਹੀ ਤੇਜ਼ੀ ਨਾਲ ਚੱਲਦਾ ਹੈ ਔਰ ਉਸਦੀ ਐਵਰੇਜ ਵੀ ਕਾਫ਼ੀ ਜ਼ਿਆਦਾ ਹੈ ਸ ਅੱਜ ਕੱਲ੍ਹ ਤਾਂ ਸਭ ਤੋਂ ਜ਼ਿਆਦਾ ਐਵਰੇਜ ਸਪਲੈਂਡਰ ਦੀ ਹੈਗੀ ਹੈ ਜੋ ਕਿ ਪੰਤਾਲੀ ਦੀ ਐਵਰੇਜ ਦਿੰਦਾ ਹੈ ਇਸ ਨਾਲ ਕਾਫ਼ੀ ਤੇਲ ਵੀ ਘੱਟ ਖਾਂਦਾ ਸਾਡੇ ਫ਼ਾਇਦੇ ਵੀ ਬੜੇ ਆ ਸਾਡੇ ਪੈਸੇ ਵੀ ਬਚੇ ਜਾਂਦੇ ਆ ਔਰ ਪੈਟਰੋਲ ਵੀ ਬਚ ਜਾਂਦਾ ਹਨ ਅਤੇ ਅਸੀਂ ਉਸ ਨਾਲ ਖੁੱਲ੍ਹੀ ਖੁੱਲ੍ਹੀ ਜਗ੍ਹਾ 'ਤੇ ਦੂਰ ਦੂਰ ਤੱਕ ਜਾ ਕੇ ਘੁੰਮ ਵੀ ਸਕਦੇ ਹਾਂ ਅਤੇ ਸਾਨੂੰ ਹੋਰ ਵੀ ਕਾਫ਼ੀ ਫ਼ਾਇਦੇ ਹੋ ਜਾਂਦੇ ਹਨ ਆਪਾਂ ਪੂਰਾ ਆਪਣਾ ਆਲਾ ਦੁਆਲਾ ਮਤਲਬ ਕਿ ਵਾਤਾਵਰਨ ਨੂੰ ਖੁੱਲ੍ਹੀ ਤਰੀਕੇ ਨਾਲ ਦੇਖ ਸਕਦੇ ਹਾਂ ਜਿਸ ਨਾਲ ਸਾਨੂੰ ਆਪਣੇ ਆਲੇ ਦੁਆਲੇ ਕਾਫ਼ੀ ਆਪਣੇ ਵਾਤਾਵਰਨ ਦਾ ਕਾਫ਼ੀ ਮਾਹੌਲ ਪਤਾ ਚੱਲ ਜਾਂਦਾ ਹੈ ਜਿਸ ਨਾਲ ਅਸੀਂ ਬਹੁਤ ਹੀ ਆਨੰਦਿਤ ਫੀਲ ਕਰਦੇ ਹਾਂ ਬਾਇਕ ਦਾ ਹੋਰ ਵੀ ਬਹੁਤ ਫ਼ਾਇਦੇ ਹਨ ਬਾਇਕ 'ਤੇ ਸਾਨੂੰ ਹੋਰ ਵੀ ਆਪਣੇ ਨਾਲ ਕਈ ਚੀਜ਼ਾਂ ਸਥਾਨ ਇੱਧਰ ਉੱਧਰ ਲੈ ਜਾਣ ਤੋਂ ਕਾਫ਼ੀ ਸਹਾਇਤਾ ਹੁੰਦੀ ਹੈ